ਪੰਜਾਬ ਦੇ ਲੋਕ ਗੀਤ ਬਹੁਤ ਹੀ ਮਸ਼ਹੂਰ ਹਨ ਇੱਥੇ ਕੁਝ ਲੋਕ ਰਲ਼ਕੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਤੇ ਲੋਕ ਗੀਤ ਗਾਏ ਜਾਂਦੇ ਹਨ ਔਰ ਆਪਣੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਇੱਥੇ ਬੀਬੀ ਸੁਰਿੰਦਰ ਕੌਰ ਅਤੇ ਯਮਲੇ ਜੱਟ ਦੇ ਲੋਕ ਗੀਤ ਬਹੁਤ ਹੀ ਪ੍ਰਚਲਿਤ ਹਨ ਯਮਲੇ ਜੱਟ ਦਾ ਲੋਕ ਗੀਤ ਜਿਵੇਂ ਕਿ ਬਾਬਾ ਨਾਨਕ ਤੇਰੀ ਲੀਲਾ ਨਿਆਰੀ ਹੈ ਨੂੰ ਅੱਜ ਵੀ ਬੱਚਾ ਬੱਚਾ ਗੁਣਗੁਣਾਉਂਦਾ ਹੈ ਔਰ ਇਸ ਤਰ੍ਹਾਂ ਦੇ ਲੋਕ ਗੀਤ ਜੋ ਕਿ ਵੱਖ ਵੱਖ ਪ੍ਰੋਗਰਾਮਾਂ 'ਤੇ ਖੁਸ਼ੀ ਦੇ ਮੌਕਿਆਂ 'ਤੇ ਗਾਏ ਜਾਂਦੇ ਹਨ ਵਿਆਹ ਦੇ ਵੇਲੇ ਜਾਂ ਕਿਸੇ ਨੂੰ ਤੇਲ ਚੜ੍ਹਨ ਦੀ ਰਸਮ ਜਦੋਂ ਹੁੰਦੀ ਹੈ ਤਾਂ ਪਿੰਡ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਆਪਸ 'ਚ ਉਹਦੀ ਇਹ ਲ ਲੋਕ ਗੀਤ ਗੁਣਗੁਣਾਉਂਦੀਆਂ ਹਨ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ